ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਆਮ ਬੰਦੇ ਦੀ ਜ਼ਿੰਦਗੀ ਨੂੰ ਇਸ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ ਜਿਹੜੀ ਕਿ ਰੋਜ਼ ਆਪਣਾ ਮੋਟਰਸਾਈਕਲ ਚਲਾ ਕੇ ਕੰਮ ਕਾਰ 'ਤੇ ਜਾਂਦੇ ਹਨ ਜਿਨ੍ਹਾਂ ਦੀ ਤਨਖਾਹ ਘੱਟ ਹਨ ਪ੍ਰਾਈਵੇਟ ਕੰ ਚ ਕੰਪਨੀਆਂ 'ਚ ਕੰਮ ਕਰਦੇ ਹਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀਆਂ ਹਨ ਕਿਉਂਕਿ ਉਹਨਾਂ ਦੀ ਐਨੀ ਤਨਖਾਹ ਨਹੀਂ ਹੁੰਦੀ ਜਿੰਨਾ ਉਹਨਾਂ ਦਾ ਪੈਟਰੋਲ ਦਾ ਖਰਚਾ ਹੋ ਜਾਂਦਾ ਹੈ ਜਿਵੇਂ ਕਿ ਹੁਣ ਡਿਲੀਵਰੀ ਵਾਲ਼ੇ ਹੋ ਗਏ ਡਿਲੀਵਰੀ ਵਾਲ਼ੇ ਆਪਣੇ ਬੰਦੇ ਜੀ ਉਹਨਾਂ ਉਹਨਾਂ ਸਾਰਾ ਦਿਨ ਮੋ ਮੋਟਰਸਾਈਕਲ 'ਤੇ ਘੁੰਮਣਾ ਹੁੰਦਾ ਹੈ ਅਤੇ ਪੈਟਰੋਲ ਕਿਤੇ ਨਾ ਕਿਤੇ ਵੱਧਦੀਆਂ ਕੀਮਤਾਂ ਉਹਨਾਂ ਲਈ ਹਾਨੀਕਾਰਕ ਹਨ ਜਿਸ ਨਾਲ ਉਹਨਾਂ ਦਾ ਅੱਧਾ ਦਿਨ ਤਾਂ ਪੈਟਰੋਲ ਦੀ ਖਰਚਾ ਕੱਢਣ 'ਤੇ ਲੱਗ ਜਾਂਦਾ ਹੈ ਅਤੇ ਇਹ ਇਸਦਾ ਇਸਤੇਮਾਲ ਪੈਟਰੋਲ ਡੀਜ਼ਲ ਇਸਦਾ ਜੋ ਕਿ ਹਾਨੀਕਾਰਕ ਹਨ ਇਹ ਵਾਤਾਵਰਨ ਲਈ ਵੀ ਇਹ ਪ੍ਰਦੂਸ਼ਣ ਜ਼ਿਆਦਾ ਕਰਦੀਆਂ ਹਨ ਜਿਵੇਂ ਕਿ ਹੁਣ ਡੇਲੀ ਜਾ ਰਹੀਆਂ ਡੇਲੀ ਲੱਖਾਂ ਹੀ ਲੋਕ ਇੱਧਰ ਉੱਧਰ ਜਾਂਦੇ ਹਨ ਉਹ ਮੋਟਰਸਾਇਕਲ ਧੂਏਂ ਛੱਡਦੇ ਹਨ ਗੱਡੀਆਂ ਧੂੰਆਂ ਛੱਡਦੀਆਂ ਹਨ ਉਹ ਕਿਤੇ ਨਾ ਕਿਤੇ ਅੱਗੇ ਵਾਤਾਵਰਣ ਨੂੰ ਵੀ ਨੁਕਸਾਨ ਕਰਦੇ ਹਨ ਉਹਦੇ ਜਿਹੜੀ ਕਿ ਵਾਤਾਵਰਣ ਦੀ ਪ੍ਰਕਿਰਿਆ ਹੁੰਦੀ ਉਹਨੂੰ ਵੀ ਹਿਲਾਉਂਦੀਆਂ ਹਨ ਅਤੇ ਸ਼ਾਇਦ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਕਿਤੇ ਨਾ ਕਿਤੇ ਸਹੀ ਵੀ ਹਨ ਜੋ ਕਿ ਵਿਹਲੀ ਮੰਡੀਰ ਹੁੰਦੀ ਹੈ ਉਹ ਮੋਟਰਸਾਇਕਲ ਚੱਕ ਕੇ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਸ਼ਾਇਦ ਉਹਨਾਂ 'ਤੇ ਵੀ ਬਹੁਤ ਹੀ ਜ਼ਿਆਦਾ ਘੱਟ ਅਸਰ ਉਹਨਾਂ 'ਤੇ ਵੀ ਜ਼ਿਆਦਾ ਅਸਰ ਪਿਆ ਹੈ ਉਹ ਉਹ ਇੱਧਰ ਉੱਧਰ ਜਾਣ ਨਾਲ ਅ ਜਾਣਾ ਘੱਟ ਗਏ ਹਨ ਜਿਸ ਨਾਲ ਸ਼ਾਇਦ ਵੱਧਦਾ ਪੋਲਿਊਸ਼ਨ ਵੀ ਕਿਤੇ ਨਾ ਕਿਤੇ ਰੁਕ ਰਿਹਾ ਹੈ ਘੱਟ ਹੋ ਰਿਹਾ ਹੈ